ਜਿੱਥੇ ਤੱਕ ਖੇਤੀ ਸਥਾਨਕ ਭਾਈਚਾਰੇ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਚਾਹੀਦਾ ਕਿ ਆਪਸ ਵਿੱਚ ਰਲ਼ ਮਿਲ ਕੇ ਰਹਿਣ ਆਪਸ ਵਿੱਚ ਇਹਨਾਂ ਨੂੰ ਆਪਣਾ ਯੋਗਦਾਨ ਬਣਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਤਕਰੀਬਨ ਹੁੰਦਾ ਕੀ ਹੈ ਕਿ ਛੋਟੀ ਛੋਟੀ ਜਗ੍ਹਾ ਦੇ ਪਿੱਛੇ ਆਪਸ ਵਿੱਚ ਲੜ ਪੈਂਦੇ ਆ ਛੋਟੀ ਛੋਟੀ ਜਗ੍ਹਾ ਪਿੱਛੇ ਲੜਾਈ ਹੋ ਜਾਂਦੀ ਆ ਇਹਨਾਂ ਦੀ ਜਿਸ ਪਿੱਛੇ ਨੁਕਸਾਨ ਵੀ ਕਿਹਦਾ ਹੁੰਦਾ ਆਪਣਾ ਹੀ ਹੁੰਦਾ ਇਹਨਾਂ ਨੂੰ ਚਾਹੀਦਾ ਕਿ ਵ ਇਹਦੇ ਵਾਸਤੇ ਇੱਕ ਮੀਟਿੰਗ ਬਣਾਉਣ ਸਾਰੇ ਜਾਣੇ ਆਪਣੇ ਜਿਹੜੇ ਆ ਖੇ ਖੇਤੀ ਸਥਾਨ ਜਿਹੜੇ ਹੈਗੇ ਆ ਲੋਕ ਇਕੱਠੇ ਹੋ ਕੇ ਇਹਦੇ ਮੁਸ਼ਕਲਾਂ ਜਿਹੜੀਆਂ ਵੀ ਆ ਰਹੀਆਂ ਉਹਨਾਂ ਬਾਰੇ ਬੈਠ ਕੇ ਗੱਲਬਾਤ ਕਰਨ ਸਲਾਹ ਕਰਨ ਤਾਂ ਕਿ ਇਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਠੀਕ ਹੋ ਜਾਣ ਇਹ ਕਿਉਂਕਿ ਲੜਾਈ ਦੇ ਨਾਲ਼ ਕੋਈ ਪ੍ਰੋਬਲਮ ਹੱਲ ਨਹੀਂ ਹੋਣੀ ਬੈਠ ਕੇ ਜਦੋਂ ਅਸੀਂ ਸਲਾਹ ਕਰਾਂਗੇ ਕੋਈ ਕੋਈ ਕਿਸ ਤਰ੍ਹਾਂ ਵਧੀਆ ਸਲਾਹ ਦਏਗਾ ਕਿਸ ਤਰ੍ਹਾਂ ਦਏਗਾ ਉਹਦੇ ਨਾਲ਼ ਕੀ ਹੋਏਗਾ ਕਿ ਤੁਹਾਨੂੰ ਕਿ ਇੱਕ ਸੁਝਾਅ ਮਿਲ ਜਾਏਗਾ ਇਹ ਆਪਣੀ ਮੁਸ਼ਕਿਲਾਂ ਨੂੰ ਠੀਕ ਕਰਨ ਲਈ ਵੀ ਛੋਟੀ ਛੋਟੀ ਗੱਲ ਛੋਟੀ ਛੋਟੀ ਜਗ੍ਹਾ ਪਿੱਛੇ ਤਕਰੀਬਨ ਲੋਕ ਲੜ ਪੈਂਦੇ ਆ ਐਸ ਚੀਜ਼ ਨੂੰ ਇਹਦਾ ਇੱਕੋ ਹੀ ਹੱਲ ਹੈ ਕਿ ਆਪਸ ਵਿੱਚ ਰਲ਼ ਮਿਲ ਕੇ ਰਹਿਣਾ ਚਾਹੀਦਾ ਤਾਂ ਕਿ ਇਹ ਇਹਦੀ ਜਿਹੜੀ ਹੈ ਮੁਸ਼ਕਿਲ ਜਿਹੜੀ ਹੈ ਬਿਲਕੁਲ ਨਾ ਆਏ